ਮੈਂ ਆਪਣੇ ਪਿੰਡ ਨੂੰ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਉੱਥੇ ਇੱਕ ਤਾਂ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਬਿਲਕੁਲ ਨਹੀਂ ਹੈ ਹਰ ਤਰਫ ਹਰ ਚਾਰੇ ਤਰਫ ਪੇੜ ਪੌਦੇ ਅਤੇ ਫਸਲਾਂ ਲੱਗੀਆਂ ਹਨ ਜੋ ਸਾਡੇ ਮਨ ਨੂੰ ਬਹੁਤ ਭਾਉਂਦੀਆਂ ਹਨ ਅਤੇ ਸਾਡਾ ਦਿਲ ਉਹਨਾਂ ਨੂੰ ਦੇਖ ਕੇ ਰੂਬਰੂ ਖੁਸ਼ ਖੁਸ਼ ਰਹਿੰਦਾ ਹਮੇਸ਼ਾ ਅਸੀਂ ਪਿੰਡ ਵਿੱਚ ਸਾਰੇ ਹੀ ਕੰਮ ਆਪ ਕਰਦੇ ਹਾਂ ਅਤੇ ਇਸ ਕਰਕੇ ਸਾਡੇ ਸਰੀਰ ਦੀ ਕਸਰਤ ਵੀ ਇਸ ਨਾਲ ਹੀ ਹੋ ਜਾਂਦੀ ਹੈ ਹੋਰ ਗੱਲ ਕਰੀਏ ਪਿੰਡ ਦੀ ਤਾਂ ਪਿੰਡ ਦਾ ਜਿਹੜਾ ਸਮਾਜਿਕ ਵਾਤਾਵਰਨ ਦੇਖੀਏ ਤਾਂ ਸਾਰੇ ਰਲ ਮਿਲ ਕੇ ਰਹਿੰਦੇ ਹਨ ਸਾਰੇ ਖੁਸ਼ ਰਹਿੰਦੇ ਹਨ ਕਿਸੇ ਦੇ ਵੀ ਦੁਖੀ ਹੋਵੇ ਚਾਹੇ ਗਮੀ ਵਿੱਚ ਇੱਕ ਦੂਸਰੇ ਦਾ ਬਹੁਤ ਸਾਥ ਦਿੰਦੇ ਹਨ ਇਸ ਕਰਕੇ ਮੈਨੂੰ ਆਪਣਾ ਪਿੰਡ ਬਹੁਤ ਪਸੰਦ ਹੈ ਥੈਂਕ ਯੂ ਸੋ ਮਚ